ਪੰਜਾਬ ਦੀ ਤਿੰਨ ਹਿੱਸਿਆਂ ਵਿੱਚ ਵੰਡ ਅਤੇ ਰਾਜ ਦੀ ਰਾਜਧਾਨੀ ਚੰਡੀਗੜ੍ਹ ਦੇ ਬਣ ਜਾਣ ਮਗਰੋਂ ਅਜੀਤਗੜ੍ਹ ਦੀ ਸਥਾਪਨਾ ਕੀਤੀ ਗਈ ਅੱਜ ਅਜੀਤਗੜ੍ਹ ਅਤੇ ਚੰਡੀਗੜ੍ਹ ਗੁਆਂਢੀ ਇਲਾਕੇ ਹਨ ਬਸ ਪੰਜਾਬ ਅਤੇ ਚੰਡੀਗੜ੍ਹ ਕੇਂਦਰ ਸ਼ਾਸ਼ਤ ਖੇਤਰੀ ਸੀਮਾ ਇਹਨਾਂ ਨੂੰ ਵੱਖ ਕਰਦੀ ਹੈ ਅਤੇ ਹੁਣ ਮੋਹਾਲੀ ਦੇ ਵਿੱਚ ਕਾਰਖਾਨੇ ਖੁੱਲ੍ਹ ਗਏ ਹਨ ਅਤੇ ਲੋਕ ਇੱਥੇ ਰੁਜ਼ਗਾਰ ਲਈ ਆਉਂਦੇ ਹਨ